ਸਾਡੇ ਖੇਤਰ ਵਿੱਚ ਹਿੰਦੂ ਧਰਮ ਦਾ ਪਾਲਣ ਕੀਤਾ ਜਾਂਦਾ ਹੈ ਅਤੇ ਹਿੰਦੂ ਧਰਮ ਦੇ ਲੋਕ ਆਪਣੇ ਭਗਵਾਨ ਕੋਲ ਟੈਂਪਲ ਜਾਂਦੇ ਹਨ ਭਗਵਾਨ ਦੇ ਲਈ ਟੈਂਪਲ ਜਾਂਦੇ ਹਨ ਅਤੇ ਕ੍ਰਿਸਚਨਸ ਚਰਚ ਜਾਂਦੇ ਹਨ ਅਤੇ ਜੋ ਮੁਸਲਿਮ ਲੋਕ ਹੁੰਦੇ ਹਨ ਉਹ ਦਰਗਾਹ ਜਾਂਦੇ ਹਨ ਮਸਜਿਦ ਜਾਂਦੇ ਹਨ ਉਹ ਉੱਥੇ ਜਾ ਕੇ ਜਿਵੇਂ ਕਿ ਹਿੰਦੂ ਲੋਕ ਹੋ ਗਏ ਉੱਥੇ ਜਾ ਕੇ ਪਾਠ ਕਰਦੇ ਹਨ ਅਤੇ ਕਈ ਲੋਕ ਸਿੱਖ ਨੂੰ ਵੀ ਮੰਨਦੇ ਹਨ ਅਤੇ ਉਹ ਗੁਰਦੁਆਰੇ ਜਾਂਦੇ ਹਨ ਅ ਆਪਣੀ ਅਰਦਾਸ ਕਰਦੇ ਹਨ ਅਤੇ ਕ ਜੋ ਹਿੰਦੂ ਧਰਮ ਦੇ ਲੋਕ ਹੁੰਦੇ ਹਨ ਉਹ ਟੈਂਪਲ ਜਾਂਦੇ ਹਨ ਉਹ ਉੱਥੇ ਜਾ ਕੇ ਪਾਠ ਕਰਦੇ ਹਨ ਮਾਤਾ ਰਾਣੀ ਦੀ ਪੂਜਾ ਕਰਦੇ ਹਨ ਅਤੇ ਜੋ ਮੁਸਲਿਮ ਲੋਕ ਹੁੰਦੇ ਹਨ ਉਹ ਆਪਣੀ ਨਮਾਜ਼ ਪੜ੍ਹਦੇ ਹਨ ਉੱਥੇ ਜਾ ਕੇ